ਮੈਂ ਕੁਝ ਦਿਨ ਪਹਿਲਾਂ ਹੀ ਇੱਕ ਮੋਬਾਈਲਾਂ ਵਾਲੀ ਦੁਕਾਨ ਤੋਂ ਪੁਰਾਣਾ ਮੋਬਾਇਲ ਪੰਜ ਹਜ਼ਾਰ ਰੁਪਏ ਦਾ ਖਰੀਦ ਕੇ ਲੈ ਕੇ ਆਇਆ ਸੀ ਉਹ ਮੋਬਾਇਲ ਦੋ ਤੋਂ ਤਿੰਨ ਦਿਨ ਤਾਂ ਠੀਕ ਕੰਮ ਕਰਦਾ ਰਿਹਾ ਪਰ ਦੋ ਤੋਂ ਤਿੰਨ ਦਿਨਾਂ ਦੇ ਬਾਅਦ ਹੀ ਉਸ ਦੀ ਸਕਰੀਨ ਦੇ ਵਿੱਚ ਚਿੱਟੇ ਰੰਗ ਦੇ ਧੱਬੇ ਆਉਣ ਲੱਗ ਗਏ ਜਿਸ ਕਰਕੇ ਮੈਨੂੰ ਸਕਰੀਨ 'ਤੇ ਅੱਖਰ ਪੜ੍ਹਨ ਦੇ ਵਿੱਚ ਕਾਫੀ ਮੁਸ਼ਕਿਲ ਆਉਣ ਲੱਗੀ ਅਤੇ ਫਿਰ ਕੁਛ ਕੁ ਦਿਨਾਂ ਦੇ ਬਾਅਦ ਹੀ ਉਸ ਦੇ ਸਪੀਕਰ ਦੇ ਵਿੱਚੋਂ ਆਵਾਜ਼ ਆਉਣੀ ਵੀ ਹਟ ਗਈ ਜਿਸ ਕਰਕੇ ਮੈਂ ਬਹੁਤ ਪਰੇਸ਼ਾਨ ਹੋਇਆ ਅਤੇ ਫਿਰ ਉਸ ਤੋਂ ਦੋ ਕੁ ਦਿਨਾਂ ਬਾਅਦ ਹੀ ਮੈਂ ਉਸ ਨੂੰ ਦੁਕਾਨਦਾਰ ਦੇ ਕੋਲ ਦੁਬਾਰਾ ਲੈ ਕੇ ਗਿਆ ਉਸਨੇ ਮੈਨੂੰ ਉਸ ਦੀ ਰਿਪੇਅਰ ਕਰਕੇ ਦੇ ਦਿੱਤਾ ਪਰ ਦੋ ਤੋਂ ਤਿੰਨ ਦਿਨਾਂ ਦੇ ਬਾਅਦ ਹੀ ਫਿਰ ਉਹ ਚੰਗੀ ਤਰ੍ਹਾਂ ਚਾਰਜਰ ਵੀ ਨਹੀਂ ਹੋ ਰਿਹਾ ਸੀਗਾ ਅਤੇ ਮੈਂ ਫਿਰ ਤੋਂ ਦੁਬਾਰਾ ਦੁਕਾਨਦਾਰ ਦੇ ਕੋਲ ਕੰਪਲੇਂਟ ਲੈ ਕੇ ਗਿਆ ਤਾਂ ਉਸ ਨੇ ਚਾਰਜਰ ਵਾਲਾ ਪੋਰਟ ਠੀਕ ਕਰਕੇ ਦੇ ਦਿੱਤਾ ਪਰ ਜਦ ਮੈਂ ਘਰ ਲੈ ਕੇ ਆਇਆ ਉਸਨੇ ਇੱਕ ਦੋ ਦਿਨ ਫਿਰ ਠੀਕ ਕੰਮ ਕੀਤਾ ਪਰ ਇੱਕ ਤੋਂ ਦੋ ਦਿਨਾਂ ਦੇ ਬਾਅਦ ਉਹ ਫਿਰ ਤੋਂ ਹੀ ਚਾਰਜ ਹੋਣਾ ਬੰਦ ਹੋ ਗਿਆ ਜਿਸ ਕਰਕੇ ਮੈਂ ਉਸ ਦੁਕਾਨਦਾਰ ਅਤੇ ਫੋਨ ਤੋਂ ਕਾਫੀ ਨਿਰਾਸ਼ ਸੀ ਤਾਂ ਇਸ ਲਈ ਮੈਂ ਸੋਚਿਆ ਮੈਂ ਹੁਣ ਅੱਗੇ ਤੋਂ ਕੋਈ ਵੀ ਪੁਰਾਣੀ ਚੀਜ਼ ਨਹੀਂ ਖਰੀਦਾਂਗਾ